ਮੈਂ ਮਨੋਰੰਜਨ ਖ਼ਬਰਾਂ ਵਿੱਚ ਬਹੁਤ ਦਿਲਚਸਪੀ ਰੱਖਦੀ ਹਾਂ ਮੈਨੂੰ ਬੋਲੀਵੁੱਡ ਨਿਊਜ਼ ਬਹੁਤ ਪਸੰਦ ਹਨ ਮੈਂ ਬੋਲੀਵੁੱਡ ਨਿਊਜ਼ ਬਹੁਤ ਵੱਧ ਜ਼ਿਆਦਾ ਦੇਖਦੀ ਹਾਂ ਕਿਉਂਕਿ ਮੈਨੂੰ ਬੋਲੀਵੁੱਡ ਮੂਵੀਜ਼ ਬਹੁਤ ਪਸੰਦ ਹਨ ਤੁਹਾ ਅਸੀਂ ਖ਼ਬਰਾਂ ਇਸ ਕਰਕੇ ਪਸੰਦ ਕਰਦੇ ਹਾਂ ਕਿਉਂਕਿ ਸਾਨੂੰ ਪੂਰੇ ਦੇਸ਼ ਦੀਆਂ ਖ਼ਬਰਾਂ ਪਤਾ ਚੱਲ ਜਾਂਦੀਆਂ ਹਨ ਕਿ ਇੱਥੇ ਕੀ ਚੱਲ ਰਿਹਾ ਹੈ ਮਨੋਰੰਜਨ ਖ਼ਬਰਾਂ ਦੇਖਦੇ ਸਮੇਂ ਮੈਂ ਇਹ ਬਹੁਤ ਧਿਆਨ ਰੱਖਦੀ ਹਾਂ ਕੀ ਖ਼ਬਰਾਂ ਕਿਸ ਤਰ੍ਹਾਂ ਦੀਆਂ ਹਨ ਅਤੇ ਖ਼ਬਰਾਂ ਵਿੱਚ ਕੀ ਕੀ ਨਵਾਂ ਆ ਰਿਹਾ ਹੈ ਖ਼ਬਰਾਂ ਮੈਨੂੰ ਸੁਣਦੇ ਸਮੇਂ ਮੈਨੂੰ ਇਹ ਫਿ ਅਹਿਸਾਸ ਹੁੰਦਾ ਹੈ ਕਿ ਜਦੋਂ ਵੀ ਅਸੀਂ ਕਿਸੇ ਵੀ ਖ਼ਬਰ ਨੂੰ ਸੁਣਦੇ ਹਾਂ ਫਿਰ ਸਾਨੂੰ ਪਤਾ ਚੱਲਦਾ ਹੈ ਕਿ ਸਾਨੂੰ ਕਿੱਥੇ ਕੀ ਸਹੀ ਕਰਨਾ ਚਾਹੀਦਾ ਹੈ ਮੈਨੂੰ ਇਸ ਖ਼ਬਰਾਂ ਵਿੱਚ ਇੱਕ ਚੀਜ਼ ਪਸੰਦ ਨਹੀਂ ਕਿ ਜਦੋਂ ਵੀ ਕਿਸੇ ਕੁੜੀ ਉੱਪਰ ਜ਼ੁਲਮ ਹੁੰਦਾ ਹੈ ਬੱਚਿਆਂ ਉੱਪਰ ਜ਼ੁਲਮ ਹੁੰਦਾ ਹੈ ਉਹ ਖ਼ਬਰ ਸੁਣ ਕੇ ਮੇਰਾ ਮਨ ਬਹੁਤ ਦੁਖੀ ਹੁੰਦਾ ਹੈ ਪਰ ਮੈਨੂੰ ਬੋਲੀਵੁੱਡ ਦੀਆਂ ਖ਼ਬਰਾਂ ਸੁਣਨਾ ਬਹੁਤ ਪਸੰਦ ਹੈ ਮੈਂ